ਹੈਲੋ ਗੁੱਡ ਆਫਟਰਨੂਨ ਸਰ ਸਰ ਐਕਚਲੀ ਮੈਂ ਨਾ ਜੇ ਬੀ ਐਲ ਦੇ ਹੈਡਫੋਨ ਮੰਗਵਾਏ ਸੀ ਤੁਹਾਡੀ ਸਾਈਟ ਤੋਂ ਅਤੇ ਉਹਦੇ ਬਾਰੇ ਮੈਂ ਆਪਣਾ ਫੀਡਵੈਕ ਦੇਣਾ ਚਾਹੁੰਦਾ ਸੀ ਅਤੇ ਸਰ ਜੇ ਡਲਿਵਰੀ ਦੀ ਗੱਲ ਕਰਾਂ ਤਾਂ ਡਲਿਵਰੀ ਸਰ ਬਿਲਕੁਲ ਓਨ ਦੀ ਟਾਇਮ ਹੋਈ ਸੀ ਡਲਿਵਰੀ ਬਹੁਤ ਵਧੀਆ ਤਰੀਕੇ ਨਾਲ ਡਲਿਵਰੀ ਹੋਈ ਅਤੇ ਪੈਕਿੰਗ ਵੀ ਸਰ ਬਹੁਤ ਵਧੀਆ ਸੀ ਜਿਹੜੇ ਹੈਡਫੋਨ ਹੈਗੇ ਸੀ ਪ੍ਰੋਪਰ ਤਰੀਕੇ ਨਾਲ ਪੈਕ ਕੀਤੇ ਹੋਏ ਸੀ ਕਿਸੇ ਵੀ ਪਾਸੋਂ ਕੋਈ ਵੀ ਟੁੱਟਿਆ ਹੋਇਆ ਨਹੀਂ ਸੀ ਸਾਰੇ ਦਾ ਸਾਰਾ ਬਹੁਤ ਵਧੀਆ ਅੱਛਾ ਬੋਕਸ ਦੇ ਵਿੱਚ ਪੈਕ ਕੀਤਾ ਹੋਇਆ ਅਤੇ ਉਹਦੇ ਨਾਲ ਜੋ ਅਸੈਸਰੀ ਹੈਗੀ ਸੀ ਉਹ ਵੀ ਸਾਰੇ ਦੀ ਸਾਰੀ ਬਹੁਤ ਵਧੀਆ ਸੀ ਅਤੇ ਓਦੂ ਬਾਅਦ ਮੈਂ ਹੈਡਫੋਨ ਵਰਤੇ ਸਰ ਉਹਨਾਂ ਦੀ ਅਵਾਜ਼ ਅਵਾਜ਼ ਸਾਊਂਡ ਕੁਆਲਟੀ ਤਾਂ ਬਹੁਤ ਵਧੀਆ ਸੀ ਚਾਰਜਿੰਗ ਬੈਕਅਪ ਬਹੁਤ ਅੱਛਾ ਸੀ ਸਰ ਅਤੇ ਜੇ ਰੇਟ ਦੀ ਗੱਲ ਕਰਾਂ ਸਰ ਰੇਟ ਮੈਂ ਹੋਰ ਸਾਈਟਸ ਹੈਗੀਆਂ ਨੇ ਅਤੇ ਸਾਰੀਆਂ 'ਤੇ ਕੀਤਾ ਸਰਚ ਪਰ ਤੁਹਾਡੀ ਸਾਈਟ 'ਤੇ ਸਭ ਤੋਂ ਵੱਧ ਡਿਸਕਾਉਂਟ ਮੈਨੂੰ ਤੁਹਾਡੀ ਸਾਈਟਸ 'ਤੇ ਮਿਲਿਆ ਜੇ ਮੈਂ ਵੈਸੇ ਵੀ ਮਾਰਕੀਟ ਦੇ ਵਿੱਚ ਪਤਾ ਕੀਤਾ ਸੀ ਉੱਥੇ ਵੀ ਕੋਸਟਲੀ ਸੀ ਬੱਟ ਔਨਲਾਈਨ ਤੁਹਾਡੀ ਸਾਈਟ ਤੋਂ ਸਭ ਤੋਂ ਵੱਧ ਡਿਸਕਾਉਂਟ ਮੈਨੂੰ ਮਿਲਿਆ ਬਹੁਤ ਮੈਨੂੰ ਵਧੀਆ ਰੇਟ 'ਤੇ ਮਿਲੇ ਅਤੇ ਟਾਇਮ 'ਤੇ ਡਲਿਵਰੀ ਹੋਈ ਸਰ ਅਤੇ ਮੇਰਾ ਬਹੁਤ ਵਧੀਆ ਐਕਸਪੀਰੀਐਂਸ ਰਿਹਾ ਸਰ ਅਤੇ ਮੇਰਾ ਇਹ ਜ਼ਿੰਦਗੀ ਦਾ ਬਹੁਤ ਵਧੀਆ ਐਕਸਪੀਰੀਐਂਸ ਰਿਹਾ ਸਰ ਔਨਲਾਈਨ ਜਿਹੜਾ ਮੈਂ ਮੰਗਵਾਇਆ ਸੀ ਇਹ ਜੇ ਬੀ ਐਲ ਦੇ ਐਕਸਪਿਰੀ